ਹਾਂਜੀ ਮੈਨੂੰ ਕਲਾਸਿਕਲ ਗਾਣੇ ਬਹੁਤ ਪਸੰਦ ਨੇ ਤੇ ਮੈਨੂੰ ਗਜ਼ਲਾਂ ਪਸੰਦ ਨੇ ਮੈਨੂੰ ਨਜ਼ਮ ਪਸੰਦ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਗਾਣੇ ਪਸੰਦ ਨੇ ਤੇ ਜਿਹੜੇ ਕਿ ਮੈਨੂੰ ਮਤਲਬ ਮੇਰੀ ਮਿੱਟੀ ਤੋਂ ਜੋੜਦੇ ਨੇ ਤੇ ਉਹਨਾਂ ਵਿੱਚ ਉਹ ਖੁਸ਼ਬੂ ਆਉਂਦੀ ਮਿੱਟੀ ਦੀ ਜਿਹੜੇ ਰੀਅਲ ਸਿੰਗਰਸ ਨੇ ਫੋਕ ਸੋਂਗ ਦੇ ਤੇ ਜਿਹੜੇ ਗਜ਼ਲ ਗਾਂਦੇ ਨੇ ਉਹਨਾਂ ਵਿੱਚ ਇਸ ਕਰਕੇ ਮੈਂ ਗਾਣਾ ਚਾਹਾਂਗੀ ਗਜ਼ਲ ਜਾਂ ਫੋਕ ਸੋਂਗ ਅੱਗੇ